ਹੈਲੋ ਹਾਂਜੀ ਮੈਡਮ ਇਹ ਅਸ਼ੋਕਾ ਸਕੂਲ ਤੋਂ ਬੋਲਦੇ ਹੈਂ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਮੈਡਮ ਬੇਟੀ ਪੜ੍ਹਦੀ ਹੈਗੀ ਟੈਂਨਥ ਕਲਾਸ ਦੇ ਵਿੱਚ ਬਲਜੀਤ ਕੌਰ ਹਾਂਜੀ ਉਹ ਪੇਰੈਂਟਸ ਮੀਟਿੰਗ 'ਤੇ ਮੈਂ ਹਾਂਜੀ ਪੁੱਛਣਾ ਸੀ ਪੇਰੈਂਟਸ ਮੀਟਿੰਗ 'ਤੇ ਸੋਰੀ ਹਾਂ ਜੀ ਆ ਨਹੀਂ ਹੋਇਆ ਜ਼ਰੂਰੀ ਕੰਮ ਪੈ ਗਿਆ ਸੀ ਅਤੇ ਰਿਜਲਟ ਦਾ ਪਤਾ ਕਰਨਾ ਸੀ ਕਿਸ ਤਰ੍ਹਾਂ ਸਾਡਾ ਬੱਚਾ ਚੱਲ ਰਿਹਾ ਜੀ ਹਾਂਜੀ ਹਾਂਜੀ ਬੁਖਾਰ ਹੋਣ ਲੱਗ ਗਿਆ ਸੀ ਮੈਡਮ ਜੀ ਉਹ ਕਹੇ ਸੀ ਵੀ ਪੇਪਰ ਦੇ ਆਵੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਹਾਂਜੀ ਬਸ ਉਹੀ ਤੁਹਾਨੂੰ ਦੱਸਿਆ ਬੁਖਾਰ ਕਰਕੇ ਥੋੜ੍ਹਾ ਜਿਹਾ ਬਸ ਚੱਕਰ ਪੈ ਗਿਆ ਜੀ ਹਾਂਜੀ ਠੀਕ ਠੀਕ ਹੈ ਜੀ ਠੀ ਠੀਕ ਹੈ ਮੈਡਮ ਠੀਕ ਹੈ ਜੀ ਓ ਓਕੇ ਜੀ ਓਕੇ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ